ਮੈਂ ਸਿਮਰਨ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਜਿੱਦਾਂ ਕਿ ਤੁਸੀਂ ਪੁੱਛਿਆ ਕਿ ਅਸੀਂ ਮੈਟ ਤੋਂ ਬਾਹਰ ਜਾ ਕੇ ਵੀ ਯੋਗਾ ਕਰ ਸਕਦੇ ਹਾਂ ਆਪਣੇ ਜੀਵਨ ਵਿੱਚ ਹਾਂਜੀ ਬਿਲਕੁਲ ਕਰ ਸਕਦੇ ਹਾਂ ਮੈਟ ਤੋਂ ਬਗੈਰ ਵੀ ਬੜੇ ਤਰ੍ਹਾਂ ਦੀਆਂ ਐਕਸਾਈਜ਼ ਨੇ ਜਿਹੜੀਆਂ ਅਸੀਂ ਆਪਾਂ ਰੋਜ਼ਾਨਾ ਰੂਟੀਨ ਦੇ ਵਿੱਚ ਕਰ ਸਕਦੇ ਹਾਂ ਅਸੀਂ ਤੁਰਦੇ ਫਿਰਦੇ ਵੀ ਥੋੜ੍ਹੀ ਬਹੁਤ ਐਕਸਾਈਜ਼ ਕਰਦੇ ਹਾਂ ਜਿਹੜਾ ਸਾਡਾ ਤੁਰਨਾ ਫਿਰਨਾ ਵੀ ਆ ਉਹਨੂੰ ਵੀ ਇੱਕ ਐਕਸਾਈਜ਼ ਹੀ ਗਿਣਿਆ ਜਾਂਦਾ ਆ ਅਤੇ ਜਿੱਦਾਂ ਅਸੀਂ ਇੱਕ ਜਗ੍ਹਾ ਬੈਠ ਕੇ ਚੇਅਰ 'ਤੇ ਬੈਠ ਕੇ ਆਪਣੇ ਬਾਹਾਂ ਦੀ ਐਕਸਾਈਜ਼ ਕਰ ਸਕਦੇ ਹਾਂ ਮੁੱਠੀਆਂ ਬੰਦ ਕਰਕੇ ਸਿੱਧੀਆਂ ਬਾਹਾਂ ਸ ਕਰਕੇ ਉਹਨਾਂ ਨੂੰ ਗੋਲ ਗੋਲ ਘੁਮਾ ਕੇ ਆਪਣੀ ਬਾਹਾਂ ਦੀ ਐਕਸਾਈਜ਼ ਕਰ ਸਕਦੇ ਹਾਂ ਅਤੇ ਆਪਣੀਆਂ ਲੱਤਾਂ ਦੀ ਵੀ ਐਕਸਰਸਾਈਜ਼ ਕਰ ਸਕਦੇ ਹਾਂ ਅਤੇ ਆਪਣੀ ਗਰਦਨ ਦੀ ਵੀ ਐਕਸਰਸਾਈਜ਼ ਕਰ ਸਕਦੇ ਹਾਂ ਜਿੱਦਾਂ ਅਸੀਂ ਗਰਦਨ ਨੂੰ ਖੱਬੇ ਪਾਸੇ ਸੱਜੇ ਪਾਸੇ ਅੱਗੇ ਪਿੱਛੇ ਕੁਛ ਡਿਗਰੀ ਤੱਕ ਘੁਮਾ ਕੇ ਗੋਲ ਗੋਲ ਰਾਊਂਡ ਰਾਊਂਡ ਘੁਮਾ ਕੇ ਆਪਾਂ ਉਹ ਵੀ ਐਕਸਾਈਜ਼ ਕਰ ਸਕਦੇ ਹਾਂ ਜਿਹੜੀ ਕਿ ਸਰਵਾਈਕਲ ਵਾਸਤੇ ਬਹੁਤ ਸਹੀ ਹੈ ਜਿਹੜੀ ਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਸਰਵਾਈਕਲ ਦੀ ਆਮ ਹੀ ਪ੍ਰੋਬਲਮ ਹੋ ਗਈ ਹੈ ਜਿਹੜੀ ਕਿ ਇਹ ਐਕਸਾਈਜ਼ ਸਾਡੀਆਂ ਨਾੜਾਂ ਨੂੰ ਬਲੱਡ ਤੋਰਦੀ ਹੈ ਅਤੇ ਸਾਡੀ ਸਰਵਾਈਕਲ ਦੀ ਪ੍ਰੋਬਲਮ ਨੂੰ ਘਟਾਉਂਦੀ ਹੈ ਇਸੇ ਤਰ੍ਹਾਂ ਹੀ ਆਪਾਂ ਇੱਕ ਬੋਲ ਗੇਂਦ ਹੱਥ 'ਚ ਲੈ ਕੇ ਉਹਨੂੰ ਪ੍ਰੈਸ ਕਰ ਸਕਦੇ ਹਾਂ ਜਿਹਦੇ ਨਾਲ ਸਾਡੀਆਂ ਬਾਹਾਂ ਦੀਆਂ ਉਂਗਲਾਂ ਦੀਆਂ ਹੱਥਾਂ ਦੀਆਂ ਨਾੜੀਆਂ ਦਾ ਬਲੱਡ ਸਰਕੁਲੇਸ਼ਨ ਸਹੀ ਹੁੰਦਾ ਆ ਅਤੇ ਸਾਡੇ ਮਤਲਬ ਹੱਥਾਂ ਦੀ ਬਾਹਾਂ ਦੀ ਐਕਸਸਾਈਜ਼ ਹੁੰਦੀ ਆ ਜ਼ਰੂਰੀ ਨਹੀਂ ਹੈ ਕਿ ਮੈਟ 'ਤੇ ਹੀ ਬਹਿ ਕੇ ਅਸੀਂ ਯੋਗਾ ਕਰ ਸਕਦੇ ਹਾਂ ਯੋਗਾ ਕਰਨ ਦਾ ਐਕਸਾਈਜ਼ ਕਰਨ ਦੇ ਹੋਰ ਵੀ ਬੜੇ ਤਰੀਕੇ ਨੇ ਰੋਜ਼ਾਨਾ ਰੂਟੀਨ ਦੇ ਵਿੱਚ ਤੁਸੀਂ ਇੱਕ ਸਿੰਪਲ ਵਾਕ ਵੀ ਕਰੋਗੇ ਤਾਂ ਉਹ ਵੀ ਇੱਕ ਐਕਸਰਸਾਈਜ਼ ਹੀ ਗਿਣੀ ਜਾਂਦੀ ਹੈ ਸੋ ਇਸੇ ਤਰ੍ਹਾਂ ਬੜੇ ਤਰ੍ਹਾਂ ਦੀਆਂ ਐਕਸਰਸਾਈਜ਼ ਨੇ ਬੜੇ ਤਰ੍ਹਾ ਦੇ ਯੋਗਾ ਨੇ ਜਿੱਦਾਂ ਅਸੀਂ ਇੱਕ ਆਪਣੇ ਬੈਡ 'ਤੇ ਬਹਿ ਕੇ ਵੀ ਕਰ ਸਕਦੇ ਹਾਂ ਬੈਡ 'ਤੇ ਲੰਮੇ ਪੈ ਕੇ ਵੀ ਆਪਾਂ ਲੱਤਾਂ ਫੋਲਡ ਕਰਕੇ ਆਪਣੇ ਲੱਤਾਂ ਦੀ ਐਕਸਰਸਾਈਜ਼ ਕਰ ਸਕਦੇ ਹਾਂ ਅਤੇ ਯੋਗਾ ਕਰ ਸਕਦੇ ਹਾਂ ਸੋ ਅਸੀਂ ਘਾਹ 'ਤੇ ਬੈਠ ਕੇ ਵੀ ਫਰੈਸ਼ ਮਾਰਨਿੰਗ ਟਾਈਮ ਦੇ ਵਿੱਚ ਯੋਗਾ ਕਰ ਸਕਦੇ ਹਾਂ ਐਕਸਰਸਾਈਜ਼ ਕਰ ਸਕਦੇ ਹਾਂ ਘਾਹ 'ਤੇ ਤੁਰਨਾ ਵੀ ਇੱਕ ਬੜਾ ਲਾਭਦਾਇਕ ਹੁੰਦਾ ਆ ਸਵੇਰੇ ਸਵੇਰੇ ਮੌਰਨਿੰਗ ਦੇ ਸਮੇਂ ਸੋ ਇਸੇ ਤਰ੍ਹਾਂ ਕਈ ਤਰ੍ਹਾਂ ਦੀਆਂ ਯੋਗਾ ਵੀ ਹੋਰ ਵੀ ਨੇ ਐਕਸਾਈਜ਼ ਹੋਰ ਵੀ ਨੇ ਜਿਹੜੀਆਂ ਅਸੀਂ ਮੈਟ ਤੋਂ ਬਾਹਰ ਜਾ ਕੇ ਵੀ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੈ ਕਿ ਇੱਕ ਜਗ੍ਹਾ ਬੈਠ ਕੇ ਮੈਟ 'ਤੇ ਹੀ ਯੋਗਾ ਕੀਤਾ ਜਾਏ ਅਤੇ ਯੋਗਾ ਜ਼ਮੀਨ 'ਤੇ ਵੀ ਕਰ ਸਕਦੇ ਹਾਂ ਘਾਹ 'ਤੇ ਵੀ ਬੈਠ ਕੇ ਕਰ ਸਕਦੇ ਹਾਂ ਬੇਡ 'ਤੇ ਵੀ ਬੈਠ ਕੇ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਐਕਸਸਾਈਜ਼ ਨੇ ਜਿਹੜੀਆਂ ਅਸੀਂ ਯੋਗਾ ਕਰ ਸਕਦੇ ਹਾਂ